ਹਾਂਜੀ ਮੈਂ ਟੀ ਵੀ 'ਤੇ ਕਈ ਵਾਰ ਖਬਰਾਂ ਦੀ ਬਹਿਸ ਦੇਖੀ ਆ ਜਿਹਦੇ ਵਿੱਚ ਕਈ ਵਾਰੀ ਜੈਂਟਸ ਵੀ ਬਹਿਸ ਕਰ ਰਿਹਾ ਹੁੰਦਾ ਏ ਕਈ ਵਾਰੀ ਲੇਡੀਜ਼ ਵੀ ਹੁੰਦੀਆਂ ਨੇ ਮੈਂ ਇੱਕ ਐਂਕਰ ਦਾ ਨਾਮ ਲਵਾਂਗੀ ਜਿਹਦਾ ਨਾਮ ਗਗਨਦੀਪ ਕੌਰ ਹੈ ਉਹ ਟੀ ਵੀ ਚੈਨਲ ਉੱਤੇ ਕਾਫੀ ਤਰ੍ਹਾਂ ਵਧੀਆ ਤਰ੍ਹਾਂ ਸਾਰੇ ਆਪਣੇ ਮਨ ਦੇ ਸਵਾਲਾਂ ਨੂੰ ਸਾਰੇ ਜਨਤਾ ਦੇ ਸਵਾਲਾਂ ਨੂੰ ਜੋ ਆਇਆ ਹੁੰਦਾ ਏ ਉਹਦੇ ਨਾਲ ਖੁੱਲ੍ਹੀ ਬਹਿਸ ਵਿੱਚ ਓਪਨਲੀ ਬੋਲਦੀ ਹੈ ਉਹ ਸੱਚੀ ਉਹ ਬਹੁਤ ਵਧੀਆ ਐਂਕਰ ਹੈ ਪਰ ਫਿਰ ਵੀ ਕਿਹਾ ਜਾਏ ਕਿ ਉਹ ਜੋ ਵੀ ਬਹਿਸ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਉਸੇ ਮੁੱਦੇ ਨੂੰ ਭਟਕਾਉਣ ਦੀ ਗੱਲ ਵੀ ਕਾਫੀ ਹੱਦ ਤੱਕ ਕੀਤੀ ਜਾਂਦੀ ਹੈ ਜੋ ਸਹੀ ਮੁੱਦਾ ਹੁੰਦਾ ਜਿਵੇਂ ਅੱਜ ਕੱਲ੍ਹ ਸਿੱਧੂ ਮੂਸੇ ਵਾਲੇ ਦੀ ਇਹ ਜਿਹੜਾ ਉਹਦੀ ਮਾਂ ਨੇ ਨਵੇਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਉਹਦੇ 'ਤੇ ਜਿੰਨੀ ਵੀ ਪੋਲਿਟਿਕਸ ਹੋ ਰਹੀ ਏ ਜੋ ਵੀ ਉਹਦੇ ਬਾਰੇ ਗੱਲਾਂ ਬਾਤਾਂ ਉਡਾਈਆਂ ਜਾ ਰਹੀਆਂ ਨੇ ਇਹ ਇੱਕ ਸਮਾਜ ਦਾ ਇੰਨਾਂ ਖਾਸ ਵਿਸ਼ਾ ਨਹੀਂ ਹੁੰਦਾ ਜਿੰਨਾਂ ਨੂੰ ਬਣਾ ਲਿਆ ਜਾਂਦਾ ਏ ਸੋ ਮੈਂ ਇਹੀ ਕਵਾਂਗੀ ਕਿ ਇਹਨਾਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਏ ਧੰਨਵਾਦ